ਹਾਂਜੀ ਕਲਾਕਾਰ ਜਿਹੜੇ ਅੱਜ ਦੇ ਹੈਗੇ ਐਗੇ ਠੀਕ ਹੈ ਉਹਨਾਂ ਨੂੰ ਮੌਕੇ ਕਿਉਂ ਨਹੀਂ ਦਿੱਤੇ ਜਾਂਦੇ ਇਸ ਕਰਕੇ ਨਹੀਂ ਦਿੱਤੇ ਜਾਂਦੇ ਕਿਉਂਕਿ ਮੀਨਸ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਦੇ ਗਾਣੇ ਜਿੱਦਾਂ ਦੇ ਹੈਗੇ ਆ ਆਪਾਂ ਫੈਮਲੀ 'ਚ ਬੈਠ ਕੇ ਦੇਖ ਨਹੀਂ ਸਕਦੇ ਠੀਕ ਹੈ ਤਾਂ ਸਾਰੀ ਫੈਮਿਲੀ ਇੱਦਾਂ ਦਾ ਹੀ ਗਾਣਾ ਹੋਵੇ ਜਿਹੜਾ ਕਿ ਸਾਰੀ ਫੈਮਿਲੀ ਬੈਠ ਕੇ ਦੇਖ ਸਕੇ ਸੁਣ ਸਕੇ ਠੀਕ ਹੈ ਉਹਦੇ ਬਾਰੇ ਉਚਿੱਤ ਕੁਛ ਉਹਨਾਂ ਨੂੰ ਪਤਾ ਲੱਗੇ ਠੀਕ ਹੈ ਚੰਗੀ ਤਰ੍ਹਾਂ ਕੋਈ ਜਾਣਕਾਰੀ ਮਿਲੇ ਠੀਕ ਹੈ ਕੋਈ ਆਪਣਾ ਕਲਚਰ ਬਾਰੇ ਪਤਾ ਲੱਗੇ ਠੀਕ ਹੈ ਇੱਦਾਂ ਦਾ ਕੁਛ ਗਾਣੇ ਵਿੱਚ ਹੋਣਾ ਚਾਹੀਦਾ ਠੀਕ ਹੈ ਫਿਰ ਹੀ ਉਹਨਾਂ ਗਾਣਿਆਂ ਨੂੰ ਆਪਾਂ ਸੁਣ ਸਕਦੇ ਹਾਂ ਠੀਕ ਹੈ ਅਤੇ ਇਹ ਹੀ ਹਨ ਜੇ ਇੱਦਾਂ ਦਾ ਕੁਛ ਹੋਰ ਵਾ ਫਿਰ ਹੀ ਆਪਾਂ ਕਲਾਕਾਰਾਂ ਨੂੰ ਬੁਲਾਵਾਂਗੇ ਠੀਕ ਹੈ ਉਹਨਾਂ ਦੀ ਲੋੜੀਂਦਾ ਸੁਣਾਂਗੇ ਤਾਂ ਜੇ ਉਹ ਚੰਗੀ ਚੀਜ਼ ਦਿਖਾਉਣਗੇ ਤਾਂ ਹੀ ਆਪਣੇ ਬੱਚੇ ਸੁਣ ਕੇ ਅੱਗੇ ਪ੍ਰਭਾਵਿਤ ਹੋਣਗੇ ਉਹਨਾਂ ਨੂੰ ਆਪਣੇ ਕਲਚਰ ਬਾਰੇ ਪਤਾ ਲੱਗੂਗਾ ਠੀਕ ਹੈ ਉਹ ਵਧੀਆ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਵਧੀਆ ਹੋਊਗਾ ਤਾਂ ਪਰਿਵਾਰ 'ਚ ਬੈਠ ਕੇ ਆਪਾਂ ਵਧੀਆ ਸੁਣਾਂਗੇ ਚੰਗਾ ਲੱਗੂਗਾ ਠੀਕ ਹੈ ਜਦੋਂ ਸਾਰਾ ਪਰਿਵਾਰ ਬੈਠ ਕੇ ਸੁਣਨਾ ਉਹ ਵਧੀਆ ਹੁੰਦਾ ਠੀਕ ਹੈ ਉੱਦੋਂ ਜ਼ਿਆਦਾ ਵਧੀਆ ਨਹੀਂ ਹੋ ਸਕਦਾ ਠੀਕ ਹੈ ਨਾ ਹਾਂਜੀ